ਮੈਂ ਡਰਾਇੰਗ ਕਰਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਸੋ ਇਸ ਕਰਕੇ ਜਿਹੜੇ ਹੈਗੇ ਹੈਗੇ ਸਕੂਲ ਲੈਵਲ ਦੇ ਵਿੱਚ ਜਿੰਨੇ ਡਰਾਇੰਗ ਦੇ ਮੁਕਾਬਲੇ ਹੁੰਦੇ ਸੀਗੇ ਕੁਛ ਵੀ ਕਲਾਕਾਰੀ ਦਿਖਾਉਣੀ ਉਹਨਾਂ ਦੇ ਵਿੱਚ ਜਿਹੜੇ ਹੈਗਾ ਮੈਂ ਪਾਰਟੀਸਪੇਟ ਕਰਦੀ ਰਹੀ ਹੈਗੀ ਹਾਂ ਪ੍ਰਦਰਸ਼ਨੀ ਦਿਖਾਉਣ ਦਾ ਕੁਛ ਵੀ ਇੱਕ ਵਾਰ ਜਿਹੜਾ ਹੈਗਾ ਮੈਂ ਆਪਣਾ ਅਨੁਭਵ ਹੈ ਜਿਹੜਾ ਉਹ ਸ਼ੇਅਰ ਕਰਨ ਜਾ ਰਹੀ ਹਾਂ ਉਹਦੇ ਵਿੱਚ ਜਿਹੜੀ ਹੈਗੀ ਹੈ ਸਾਡੇ ਸਕੂਲ ਦੇ ਵਿੱਚ ਇੱਕ ਜਿਹੜੀ ਹੈਗਾ ਹੈ ਮੁਕਾਬਲਾ ਜਿਹੜਾ ਹੈਗਾ ਡਰਾਇੰਗ ਦਾ ਹੋ ਰਿਹਾ ਸੀਗਾ ਉਸ ਦੇ ਵਿੱਚ ਮੈਂ ਵੀ ਹਿੱਸਾ ਲਿਆ ਉਹਨਾਂ ਨੇ ਮੈਨੂੰ ਓਨ ਦਾ ਸਪੋਟ ਡਰਾਇੰਗ ਕਰਨ ਨੂੰ ਕਿਹਾ ਸੋ ਮੈਂ ਉਸਦੇ ਵਿੱਚ ਮੈਨੂੰ ਇੱਕ ਬਿਲਡਿੰਗ ਦੀ ਡਰਾਇੰਗ ਕਰਨ ਬਾਰੇ ਕਿਹਾ ਸੀ ਮੈਂ ਬਿਲਡਿੰਗ ਦੇ ਜਮਾਂ ਅਗਜੈਕਟ ਸਾਹਮਣੇ ਬੈਠੀ ਹੋਈ ਸੀ ਅਤੇ ਮੈਂ ਓਥੇ ਬਿਲਡਿੰਗ ਦੇ ਮੈ ਸਾਹਮਣੇ ਬੈਠ ਕੇ ਮੈਂ ਬਿਲਡਿੰਗ ਦੀ ਐਜ ਇਟ ਇਜ ਜਿਹੜੀ ਹੈਗੀ ਹੈਗੀ ਡਰਾਇੰਗ ਕੀਤੀ ਜਿਹੜੀ ਕਿ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਸੀਗੀ ਅਤੇ ਉਹ ਦੇਖਣ ਦੇ ਵਿੱਚ ਵੀ ਬਹੁਤ ਵਧੀਆ ਬਣ ਕੇ ਆਈ ਜਿਹਦਾ ਰਿਜ਼ਲਟ ਦੇਖ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਕਿਉਂਕਿ ਉਸ ਰਿਜ਼ਲਟ ਦੇ ਵਿੱਚ ਜਿਹੜਾ ਹੈਗਾ ਮੇਰਾ ਫਸਟ ਪ੍ਰਾਈਜ ਆਇਆ ਹੋਇਆ ਸੀਗਾ ਅਤੇ ਮੈਨੂੰ ਜਿਹੜੀ ਹੈਗੀ ਹੈ ਮੈਨੂੰ ਇੱਕ ਟਰੋਫੀ ਦੇ ਨਾਲ ਨਾਲ ਜਿਹੜੀ ਹੈਗੀ ਹੈਗੀ ਕੈਸ਼ ਹੈ ਜਿਹੜੀ ਓਹ ਵੀ ਮਿਲੀ ਹੋਈ ਸੀ ਇਹ ਮੇਰਾ ਲਾਇਫ ਦਾ ਜਿਹੜਾ ਸੀਗਾ ਸਭ ਤੋਂ ਵਧੀਆ ਡਰਾਇੰਗ ਦਾ ਜਿਹੜਾ ਹੈਗਾ ਸੀਗਾ ਐਕਸਪੀਰੀਐਂਸ ਸੀਗਾ ਉਸ ਤੋਂ ਬਾਅਦ ਮੈਂ ਕਦੀ ਜਿਹੜੀ ਹੈਗੀ ਹੈਗੀ ਆਪਣੀ ਡਰਾਇੰਗ ਜਿਹੜੀ ਹੈਗੀ ਹੈ ਡਰਾਇੰਗ ਨਹੀਂ ਕੀਤੀ ਕਿਓਂ ਪਲਾ ਸਕੂਲ ਲੈਵਲ ਤੋਂ ਬਾਅਦ ਜਿਹੜੇ ਹੈਗੇ ਹੈ ਮੈਂ ਕੋਲਜ ਲੈਵਲ ਦੇ ਵਿੱਚ ਆ ਕੇ ਆਪਣੇ ਸਬਜੈਕਟ ਜਿਹੜੇ ਹੈ ਇਸ ਤਰ੍ਹਾਂ ਦੇ ਚੂਸ ਕਰ ਲਏ ਜਿਹਦੇ ਵਿੱਚ ਮੈਂ ਉਹਨਾਂ ਦੇ ਵਿੱਚ ਮੈਂ ਜ਼ਿਆਦਾ ਬਿਜੀ ਰਹਿਣ ਲੱਗ ਗਈ ਮੈਂ ਡਰਾਇੰਗ ਵਗੈਰਾ ਨਹੀਂ ਕਰ ਸਕੀ ਸੋ ਮੇਰਾ ਇੰਟ੍ਰਸਟ ਤਾਂ ਹੈਗਾ ਮੈਂ ਕ ਕਿਸੇ ਪ੍ਰੀਖਿਆ ਹੋਰ ਕਿਸਮ ਦੇ ਵਿੱਚ ਹਿੱਸਾ ਨਹੀਂ ਲਿਆ ਬੱਟ ਮੈਂ ਘਰ ਦੇ ਵਿੱਚ ਜਿਹੜੇ ਹੈਗੇ ਹੈ ਆਪਣਾ ਜਿਹੜਾ ਹੈਗਾ ਸ਼ੌਕ ਹੈ ਜਿਹੜਾ ਉਹ ਕੁਛ ਨਾ ਕੁਛ ਬਣਾ ਕੇ ਪੂਰਾ ਕਰ ਲੈਂਦੀ ਹਾਂ